ਸਰਕਾਰ ਨੇ ਸਾਡੀ ਬਿਮਾਰੀਆਂ ਲਈ ਹੁਣ ਇੱਕ ਕਾਰਡ ਬਣਾਇਆ ਹੈ ਜਿਸ ਵਿੱਚ ਪੰਜ ਲੱਖ ਤੱਕ ਦੀ ਛੂਟ ਦਿੱਤੀ ਜਾਂਦੀ ਹੈ ਜੋ ਕਿ ਸਾਨੂੰ ਇਹ ਕਾਰਡ ਅਪਲਾਈ ਕਰਾਉਣਾ ਜ਼ਰੂਰੀ ਹੁੰਦਾ ਹੈ ਅਤੇ ਇਹ ਕਾਰਡ ਸਰਕਾਰੀ ਤਾਂ ਸਰਕਾਰੀ ਪ੍ਰਾਈਵੇਟ ਵਿੱਚ ਵੀ ਚਲਦਾ ਹੈ ਸਾਨੂੰ ਇਹ ਬਹੁਤ ਹੀ ਲਾਭਦਾਇਕ ਹੈ ਹੁਣ ਜੋ ਕਿ ਗਰੀਬ ਬੰਦਾ ਪਹਿਲਾਂ ਇਲਾਜ ਨਹੀਂ ਕਰਵਾ ਸਕਦਾ ਸੀ ਹੁਣ ਉਹ ਆਪਣਾ ਇਲਾਜ ਕਰਵਾ ਸਕਦਾ ਹੈ ਗਰੀਬ ਤੋਂ ਗਰੀਬ ਵੀ ਆਪਣਾ ਇਲਾਜ ਕਰਵਾ ਸਕਦਾ ਹੈ ਸਰਕਾਰ ਨੇ ਇਹ ਸਕੀਮ ਬਹੁਤ ਹੀ ਵਧੀਆ ਕੱਢੀ ਹੈ ਸਰਕਾਰ ਦਾ ਮੈਂ ਧੰਨਵਾਦੀ ਹਾਂ ਧੰਨਵਾਦ